ਸਿੱਖਿਆ ਜੋ ਹੈ ਵੋ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਚਾਹੇ ਇੱਕ ਧੀ ਹੈ ਚਾਹੇ ਉਹ ਭੈਣ ਹੈ ਚਾਹੇ ਉਹ ਮੇਰੀ ਦੋਸਤ ਹੈ ਕਿਉਂਕਿ ਸਿੱਖਿਆ ਹੀ ਜੋ ਹੈ ਸਾਡੇ ਦੇਸ਼ ਨੂੰ ਜੋ ਹੈ ਉੱਚੇ ਪੱਧਰ ਤੱਕ ਲੈ ਕੇ ਜਾਂਦੀ ਹੈ ਉਹ ਪਹਿਲੇ ਜਮਾਨੇ ਸੀਗੇ ਜਿਹਦੇ ਵਿੱਚ ਕੁੜੀ ਨੂੰ ਪੜ੍ਹਨ ਲਈ ਅੱਗੇ ਨਹੀਂ ਸੀ ਭੇਜਿਆ ਜਾਂਦਾ ਪਰ ਹੁਣ ਮੈਂ ਆਪ ਚਾਹੇ ਮੇਰੀ ਭੈਣ ਚਾਹੇ ਦੋਸਤ ਉਹਨੂੰ ਮੈਂ ਅੱਗੇ ਪੜ੍ਹਨ ਲਈ ਬਹੁਤ ਜ਼ਿਆਦਾ ਜੋ ਹੈ ਉਹ ਇਨੀਸ਼ੀਏਟ ਕਰਦਾ ਹਾਂ ਕਿਉਂਕਿ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਸਾਰੇ ਡਿਪਾਰਟਮੈਂਟ ਦੇ ਵਿੱਚ ਜ਼ਿਆਦਾਤਰ ਲੇਡੀਜ਼ ਹੀ ਜੋ ਇੱਕ ਅੱਛੇ ਤਰੀਕੇ ਨਾਲ ਕੰਮ ਕਰਦੀਆਂ ਹਨ ਅਤੇ ਅੱਜ ਕੱਲ੍ਹ ਉਹ ਸਮਾਂ ਨਹੀਂ ਹੈ ਜੋ ਕੁੜੀਆਂ ਨੂੰ ਘਰ ਬਿਠਾ ਕੇ ਰੱਖਿਆ ਜਾਵੇ ਅੱਜ ਕੱਲ੍ਹ ਕੁੜੀਆਂ ਮੁੰਡੇ ਸਾਰੇ ਬਰਾਬਰ ਅਤੇ ਬਰਾਬਰ ਚਲਦੇ ਹਨ ਇਸ ਕਰਕੇ ਸਿੱਖਿਆ ਜੋ ਹੈ ਉਹ ਸਿਰਫ ਮੁੰਡਿਆਂ ਲਈ ਨਹੀਂ ਕੁੜੀਆਂ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਿੱਖਿਆ ਜੋ ਹੈ ਉਹ ਆਪਣੇ ਦੇਸ਼ ਆਪਣੇ ਘਰ ਆਪਣੇ ਸਮਾਜ ਨੂੰ ਬਹੁਤ ਉੱਚੇ ਪੱਧਰ ਤੱਕ ਲੈ ਕੇ ਜਾਂਦੀਆਂ ਨੇ ਇਸ ਕਰਕੇ ਮੈਂ ਇਹੀ ਕਹਿੰਦਾ ਹੈ ਵੀ ਜਿਹੜੀ ਸਿੱਖਿਆ ਉਹ ਸਾਰਿਆਂ ਲਈ ਨਾ ਕਿ ਲੜ ਲੜਕਿਆਂ ਲਈ ਉਹ ਲੜਕੀਆਂ ਲਈ ਵੀ ਜ਼ਰੂਰੀ ਹੈ ਇਸ ਕਰਕੇ ਮੈਂ ਚਾਹੇ ਉਹ ਮੇਰੀ ਧੀ ਭੈਣ ਜਾਂ ਦੋਸਤ ਹੈ ਉਹਨੂੰ ਮੈਂ ਅੱਗੇ ਪੜਨ ਲਈ ਜੋ ਵੀ ਮੇਰੇ ਕੋਲ ਕੋਸ਼ਿਸ਼ ਹੁੰਦੀ ਹੈ ਉਹ ਮੈਂ ਕਰਦਾ ਹਾਂ